ਨਮਸਕਾਰ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਸੀਂ ਅਸੀਂ ਆਪਣੇ ਵਿਲੱਖਣ ਅਨੁਭਵ ਦਾ ਵਰਨਣ ਕਰਦੇ ਹਾਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜੰਮੂ ਗਏ ਸੀ ਉੱਥੇ ਸਾਨੂੰ ਉਹਨਾਂ ਨੇ ਬਹੁਤ ਆਪਣੇ ਇਲਾਕੇ ਬਾਰੇ ਬਹੁਤ ਕੁਛ ਦੱਸਿਆ ਇੱਕ ਤਾਂ ਉਹਨਾਂ ਦੇ ਨਾਲ ਹੀ ਚਰਚ ਸੀ ਜਿੱਥੇ ਜਾ ਕੇ ਸਾਨੂੰ ਬਹੁਤ ਅੱਛਾ ਲੱਗਿਆ ਉੱਥੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਸੀ ਅਤੇ ਪ੍ਰੇ ਪ੍ਰਾਰਥਨਾ ਕਰਵਾਉਂਦੇ ਸੀ ਅਤੇ ਚੰਗੇ ਹੋ ਕੇ ਜਾਂਦੇ ਸੀ ਉਸ ਦੇ ਨਾਲ ਹੀ ਇੱਕ ਘੁੰਮਣ ਫਿਰਨ ਲਈ ਵਾਹਗਾ ਬਾਰਡਰ ਹੈ ਉੱਥੇ ਵੀ ਬਹੁਤ ਅੱਛਾ ਵਿਊ ਹੈ ਅਤੇ ਲੋਕ ਦੂਰੋਂ ਦੂਰੋਂ ਆਉਂਦੇ ਹਨ ਦੇਖਣ ਲਈ ਉੱਥੇ ਪਹਾੜੀ ਇਲਾਕਾ ਹੈ ਉ ਉਥੇ ਜਾ ਕੇ ਸਾਨੂੰ ਬਹੁਤ ਹੀ ਅੱਛਾ ਲੱਗਿਆ ਅਤੇ ਔਰ ਉੱਥੇ ਦੇਖਣ ਨੂੰ ਬਹੁਤ ਹੀ ਅੱਛਾ ਇਲਾਕਾ ਹੈ ਬੱਚਿਆਂ ਦੇ ਖੇਡਣ ਲਈ ਬਹੁਤ ਸਾਰੇ ਪੰਘੂੜੇ ਲੱਗੇ ਹਨ ਗਰਾਊਂਡ ਬਣੇ ਹਨ ਅਤੇ ਫਿਸ਼ ਪਾਰਕ ਬਣੀ ਹੋਈ ਹੈ ਜੋ ਕਿ ਬੱਚੇ ਬਹੁਤ ਪਸੰਦ ਕਰਦੇ ਹਨ ਘੁੰਮਣਾ ਫਿਰਨਾ ਅਤੇ ਉੱਧਰੋਂ ਆਉਂਦੇ ਟਾਈਮ ਇੱਕ ਮੰਦਰ ਹੈ ਚੀਚੀ ਮਾਤਾ ਦਾ ਬਹੁਤ ਦੁਨੀਆ ਪਸੰਦ ਕਰਦੀ ਹੈ ਜਾਣਾ ਲੋਕ ਸ਼ਰਧਾਲੂ ਦੂਰੋਂ ਦੂਰੋਂ ਆ ਕੇ ਉਸ ਜਗ੍ਹਾ 'ਤੇ ਜਾਣਾ ਪਸੰਦ ਕਰਦੇ ਹਨ ਅਤੇ ਨਾਲ ਹੀ ਉੱਥੇ ਵੈਸ਼ਨੋ ਮਾਤਾ ਦਾ ਮੰਦਰ ਹੈ ਜੋ ਕਿ ਕਟਰੇ ਵਿੱਚ ਮਸ਼ਹੂਰ ਮਸ਼ਹੂਰ ਹੈ ਉਹਦੇ ਵਿੱਚ ਅੱਧ ਕੁਆਰੀ ਮਾਤਾ ਵੀ ਹੈ ਅਤੇ ਸਭ ਜਗ੍ਹਾ 'ਤੇ ਉਹਨਾਂ ਨੇ ਆਪਣੇ ਇਲਾਕਿਆਂ ਬਾਰੇ ਜੋ ਵੀ ਉੱਧਰ ਮੰਦਰ ਹੈ ਜਾਂ ਇਹ ਜਗ੍ਹਾ ਘੁੰਮਣ ਫਿਰਨ ਨੂੰ ਹੈ ਸਾਨੂੰ ਉਹਨਾਂ ਨਾਲ ਮਿਲ ਕੇ ਬਹੁਤ ਹੀ ਚੰਗਾ ਲੱਗਿਆ ਧੰਨਵਾਦ